ਪੰਜਾਬ ਦੇ ਵਿੱਚ ਜਿਹੜੇ ਮਹੱਤਵਪੂਰਨ ਲੋਕ ਨੇ ਜਿਹਨਾਂ ਨੇ ਸਮਾਜ ਨੂੰ ਦੇਣ ਦਿੱਤੀ ਹੈ ਸੇਧ ਦਿੱਤੀ ਹੈ ਉਹਨਾਂ ਦੇ ਜਿਹੜੇ ਦਿਨ ਨੇ ਉਹਨਾਂ ਨੂੰ ਬੜੀ ਸ਼ਰਧਾ ਦੇ ਨਾਲ ਬੜੀ ਭਾਵਨਾ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਅਤੇ ਬੜੀ ਧੂਮ ਧਾਮ ਦੇ ਨਾਲ ਉਹਨਾਂ ਸਭ ਨੂੰ ਮਨਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਕਿਸੇ ਵੀ ਗੁਰੂ ਪੀਰ ਦਾ ਜਦੋਂ ਅ ਜਨਮ ਦਿਹਾੜਾ ਹੁੰਦਾ ਹੈ ਤਾਂ ਗੁਰਦੁਆਰੇ ਜਿਹੜੇ ਹੈ ਨੇ ਉਹਨਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਸਜਾਇਆ ਜਾਂਦਾ ਹੈ ਕਾਫੀ ਦੇਰ ਉਸ ਗੁਰਪੁਰਬ ਤੋਂ ਪਹਿਲਾਂ ਹੀ ਜਿਹੜੇ ਗੁਰਦੁਆਰੇ ਨੇ ਉਹਨਾਂ ਦੀ ਸਜਾਵਟ ਜਿਹੜੀ ਸ਼ੁਰੂ ਹੋ ਜਾਂਦੀ ਸੰਗਤਾਂ ਬਿਨਾਂ ਕਿਸੇ ਲੈਣ ਦੇਣ ਦੇ ਫਰੀ ਦੇ ਵਿੱਚ ਇਹ ਸੇਵਾਵਾਂ ਜਿਹੜੀਆਂ ਨਿਭਾਉਂਦੀਆਂ ਨੇ ਅਤੇ ਸੱਚੇ ਮਨ ਤੋਂ ਗੁਰਦੁਆਰਿਆਂ ਨੂੰ ਜਿਹੜਾ ਸਜਾਇਆ ਜਾਂਦਾ ਹੈ ਬਾਬਾ ਜੀ ਦੀ ਜਿਹੜੀ ਪਾਲਕੀ ਹੈ ਉਹਨੂੰ ਸਜਾਇਆ ਜਾਂਦਾ ਹੈ ਅਤੇ ਜਿਹੜੇ ਨਗਰ ਕੀਰਤਨ ਨੇ ਉਹ ਕੱਢੇ ਜਾਂਦੇ ਨੇ ਉਸ ਦਿਹਾੜੇ ਤੋਂ ਪਹਿਲਾਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਵੱਖ ਵੱਖ ਇਲਾਕਿਆਂ ਦੇ ਵਿੱਚ ਜਿਹੜੇ ਨਗਰ ਕੀਰਤਨ ਕੱਢੇ ਜਾਂਦੇ ਨੇ ਉਹਨਾਂ ਨੇ ਵਿੱਚ ਧੂਮ ਧਾਮ ਨਾਲ ਹਿੱਸਾ ਲੈਂਦੀਆਂ ਨੇ ਸ਼ਬਦ ਗਾਏ ਜਾਂਦੇ ਨੇ ਲੋਕ ਆਪਣੀ ਸ਼ਰਧਾ ਭਾਵਨਾ ਦਾ ਜਿਹੜਾ ਪ੍ਰਗਟਾਵਾ ਹੈ ਉਹ ਕਰਦੇ ਨੇ ਲੰਗਰ ਲਗਾਏ ਜਾਂਦੇ ਨੇ ਔਰ ਗੁਰਦੁਆਰਿਆਂ ਦੇ ਵਿੱਚ ਬੜੇ ਦਿਨ ਲੋਕ ਜਿਹੜੇ ਨੇ ਉਹ ਚਾਹ ਦਾ ਪਕੌੜਿਆਂ ਦਾ ਮਿਠਾਈਆਂ ਦਾ ਜਿਹੜਾ ਲੰਗਰ ਹੈ ਉਸ ਨੂੰ ਲਗਾਇਆ ਜਾਂਦਾ ਹੈ ਔਰ ਲੋਕ ਹੁੰਮ ਹੁੰਮਾ ਕੇ ਗੁਰਦੁਆਰਿਆਂ ਦੇ ਵਿੱਚ ਨਗਰ ਕੀਰਤਨਾਂ ਦੇ ਵਿੱਚ ਜਿਹੜੇ ਨੇ ਉਹ ਪੁੱਜਦੇ ਨੇ ਔਰ ਸਭ ਦੇ ਮਨ ਦੇ ਵਿੱਚ ਹੀ ਉਹ ਉਸ ਗੁਰੂ ਪੀਰ ਸੰਬੰਧੀ ਜਿਹੜੀ ਭਾਵਨਾ ਹੈ ਉਹ ਮਨ ਦੇ ਵਿੱਚ ਓਥ ਪੋਥ ਹੋਈ ਹੁੰਦੀ ਹੈ ਗੁਰੂਆਂ ਪੀਰਾਂ ਦੇ ਇਹ ਜਿਹੜੇ ਜਨਮ ਦਿਹਾੜੇ ਨੇ ਉਹ ਇੱਕ ਯਾਦਗਾਰੀ ਚਿੰਨ੍ਹ ਪੰਜਾਬ ਦੇ ਵਿੱਚ ਨੇ ਔਰ ਹਰ ਉਹਨਾਂ ਦੇ ਇਸ ਗੁਰਪੁਰਬ ਦੇ ਦਿਹਾੜੇ ਦੇ ਉੱਪਰ ਸਾਨੂੰ ਸੇਧ ਜਿਹੜੀ ਹੈ ਉਹ ਮਿਲਦੀ ਹੈ ਕਿ ਸਾਨੂੰ ਵੀ ਉਹਨਾਂ ਦੁਆਰਾ ਜਿਹੜੇ ਦੱਸੇ ਹੋਏ ਗੁਣ ਨੇ ਜਾਂ ਦੱਸੀਆਂ ਹੋਈਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਦਾ ਮਾਰਗ ਦਰਸ਼ਨ ਕਰਨਾ ਚਾਹੀਦਾ ਹੈ ਔਰ ਸਾਨੂੰ ਵੀ ਸ਼ਰਧਾ ਦੇ ਨਾਲ ਹੁੰਮ ਹੁੰਮਾ ਕੇ ਇਹਨਾਂ ਤਿਉਹਾਰਾਂ ਦੇ ਵਿੱਚ ਪੁੱਜਣਾ ਚਾਹੀਦਾ ਹੈ